ਮੇਰੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਕੁਛ ਖਾਸ ਪ੍ਰਾਪਤੀਆਂ ਤਾਂ ਨਹੀਂ ਹਨ ਪਰ ਜੋ ਮੈਨੂੰ ਯਾਦ ਹੈ ਮੈਂ ਭੰਗੜੇ ਵਿੱਚ ਪਾਰਟੀਸਪੇਟ ਕੀਤਾ ਸੀ ਜਦ ਮੈਂ ਬਾਰਵੀਂ ਜਮਾਤ ਵਿੱਚ ਪੜ੍ਹਦਾ ਸੀ ਇਸ ਵਿੱਚ ਹਿੱਸਾ ਲੈਣ ਲਈ ਮੈਨੂੰ ਮੇਰੇ ਸਰ ਨੇ ਬਹੁਤ ਮਜਬੂ ਮਜ਼ਬੂਰ ਕੀਤਾ ਸੀ ਜਿਸ ਕਾਰਨ ਮੈਂ ਇਸ ਵਿੱਚ ਪਾਰਟੀਸਪੇਟ ਕੀਤਾ ਅਤੇ ਇਸ ਚੀਜ਼ ਦਾ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਕ ਸੀ ਅਤੇ ਮੈਂ ਸ਼ੁਰੂ ਤੋਂ ਹੀ ਇਸ ਵਿੱਚ ਪਾਰਟੀਸਪੇਟ ਕਰਨਾ ਚਾਹੁੰਦਾ ਸੀ ਪਰ ਬਾਰਵੀਂ ਜਮਾਤ ਵਿੱਚ ਮੈਨੂੰ ਇਹ ਮੌਕਾ ਮਿਲਿਆ ਅਤੇ ਮੈਂ ਇਸਦੀ ਪ੍ਰੈਕਟਿਸ ਬਹੁਤ ਜ਼ੋਰ ਤ ਲਗਾ ਕੇ ਕੀਤੀ ਅਤੇ ਬਹੁਤ ਹੀ ਸ਼ਾਨਦਾਰ ਭੰਗੜਾ ਪਾਇਆ ਜਿਸ ਕਾਰਨ ਸਾਡੀ ਟੀਮ ਨੂੰ ਪਹਿਲਾਂ ਇਨਾਮ ਹਾਸਿਲ ਹੋਇਆ ਜਿਸ ਦੌਰਾਨ ਮੇਰਾ ਸ ਮੇਰੇ ਸਿਰ 'ਤੇ ਸਕੂਲ ਵਾਲੀਆਂ ਟੀਚਰਾਂ ਬਹੁਤ ਖੁਸ਼ ਸੀ ਸਾਡੇ ਸਕੂਲ ਦਾ ਨਾਮ ਹੋਰ ਵੀ ਉੱਚਾ ਹੋ ਗਿਆ ਬਾਕੀ ਸਕੂਲਾਂ ਨਾਲੋਂ ਇਸ ਕੋਂਪੀਟੀਸ਼ਨ ਵਿੱਚ ਹਿੱਸਾ ਲੈ ਕੇ ਮੇਰੇ ਘਰਦਿਆਂ ਨੂੰ ਵੀ ਬਹੁਤ ਖੁਸ਼ੀ ਮਿਲੀ ਉਹ ਵੀ ਇਸ ਜਿੱਤ ਤੋਂ ਬਹੁਤ ਖੁਸ਼ ਸੀ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੇਰੇ ਫਰੈਂਡ ਵੀ ਬਹੁਤ ਖੁਸ਼ ਹੋਏ ਇਸ ਜਿੱਤ ਲਈ